ਲੁਧਿਆਣੇ ਜ਼ਿਲ੍ਹੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਹੋਣ ਦੇ ਕਾਰਨ ਇੱਥੇ ਕਾਫੀ ਆ ਆਧੁਨਿਕ ਉਪਕਰਨ ਹਨ ਜਿਹਦੇ ਨਾਲ ਕਿ ਨਵੇਂ ਨਵੇਂ ਤਰੀਕੇ ਦੇ ਨਾਲ ਸਬਜ਼ੀਆਂ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਉਗਾਈ ਜਾਂਦੀਆਂ ਹਨ ਜਿਸ ਨੂੰ ਹੋਰ ਵਰਤੋਂ ਕਰਕੇ ਅਸੀਂ ਇੱਕ ਬੜੇ ਸਕੇਲ ਦੇ ਉੱਤੇ ਉਸ ਨੂੰ ਲਗਾ ਕੇ ਅਤੇ ਖੇਤੀਬਾੜੀ ਵਿੱਚ ਆਪਣਾ ਮੁਨਾਫਾ ਵਧਾ ਸਕਦੇ ਹਨ ਇੱਥੇ ਰੋਜ਼ ਨਵੇਂ ਨਵੇਂ ਖੋਜ ਕ ਕਰਕੇ ਅਤੇ ਲੋਕਾਂ ਨੂੰ ਇਸਦਾ ਇਸਦਾ ਲਾਭ ਜਮੀਨੀ ਤੌਰ 'ਤੇ ਪਹੁੰਚਾਇਆ ਜਾਂਦਾ ਹੈ ਜਿਸ ਕਰਕੇ ਐਗਰੀਕਲਚਰ ਯੂਨੀਵਰਸਿਟੀ ਇੱਥੇ ਬਹੁਤ ਮੰਨੀ ਪ੍ਰਮੰਨੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਲੁਧਿਆਣੇ ਵਿੱਚ ਮੋ ਜ਼ਿਆਦਾਤਰ ਖੇਤੀਬਾੜੀ ਦੇ ਇਲਾਵਾ ਕਈ ਹੋਰ ਕੰਮ ਲਈ ਵੀ ਲੋਕ ਆਉਂਦੇ ਹਨ ਪਰ ਯੂਨੀਵਰਸਿਟੀ ਕਰਕੇ ਇਸ ਨੂੰ ਜ਼ਿਆਦਾਤਰ ਖੇਤੀਬਾੜੀ ਦੇ ਨਾਲ ਹੀ ਜੋੜਿਆ ਜਾਂਦਾ ਹੈ ਧੰਨਵਾਦ